ਲਗਾਤਾਰ ਮੌਸਮ ਵਿੱਚ ਆ ਰਹੇ ਬਦਲਾਵਾਂ ਨੇ ਖੇਤੀਬਾੜੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਾਣੀ ਦੇ ਵਿੱਚ ਜ਼ਹਿਰ ਘੁਲ ਰਿਹਾ ਹੈ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਸਰਦੀਆਂ ਦਾ ਤਾਪਮਾਨ ਲਗਾਤਾਰ ਘੱਟ ਰਿਹਾ ਹੈ ਗਰਮੀਆਂ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਬੇ ਮੋਸਮੀ ਮੀਂਹ ਪੈ ਰਿਹਾ ਹੈ ਇਹ ਸਭ ਕਾਰਨਾਂ ਕਰਕੇ ਫਸਲਾਂ ਲਗਾਤਾਰ ਨੁਕਸਾਨੀਆਂ ਜਾ ਰਹੀਆਂ ਹਨ ਇਹ ਸਭ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਪਾਣੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਪਾਣੀ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ ਨਾਲਿਆਂ ਦਾ ਪਾਣੀ ਸ਼ਰਾਬ ਦੀ ਫੈਕਟਰੀ ਦਾ ਪਾਣੀ ਜੋ ਕਿ ਸਾਡੇ ਸੋਮਿਆਂ ਨੂੰ ਲਗਾਤਾਰ ਖਰਾਬ ਕਰ ਰਿਹਾ ਹੈ ਇਸ ਤੋਂ ਇਲਾਵਾ ਟੋਇਲਟਸ ਦਾ ਜੋ ਟੋਏ ਹਨ ਉਹ ਵੀ ਸਾਡੇ ਪੱਤਣਾਂ ਨੂੰ ਖਰਾਬ ਕਰ ਰਹੇ ਹਨ ਬਹੁਤ ਸਾਰੀਆਂ ਸ਼ਰਾਬ ਦੀਆਂ ਫੈਕਟਰੀਆਂ ਹਨ ਜਿਨ੍ਹਾਂ ਦਾ ਪਾਣੀ ਨਹਿਰਾਂ ਸੂਇਆ ਖਾਲਿਆ ਘੱਗਰ ਦੇ ਵਿੱਚ ਸੁੱਟਿਆ ਜਾਂਦਾ ਹੈ ਇਹ ਪਾਣੀ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਇਹ ਪਾਣੀ ਜ਼ਹਿਰੀਲਾ ਹੈ ਇਸ ਤੋਂ ਇਲਾਵਾ ਬੇਮੌਸਮੀ ਮੀਂਹ ਜੋ ਹੈ ਉਹ ਬਹੁਤ ਫਸਲਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਪੱਕੀ ਫਸਲ ਦੇ ਉੱਪਰ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਸਾਰੀ ਦੀ ਸਾਰੀ ਫਸਲ ਜੋ ਹੈ ਉਹ ਤਬਾਹ ਹੋ ਜਾਂਦੀ ਹੈ ਇਸ ਤੋਂ ਇਲਾਵਾ ਪ੍ਰਦੂਸ਼ਣ ਜੋ ਹੈ ਉਹ ਵੀ ਲਗਾਤਾਰ ਫਸਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਫੈਕਟਰੀਆਂ ਦੇ ਵਿੱਚੋਂ ਛੱਡਿਆ ਜਾਣ ਵਾਲਾ ਧੂੰਆਂ ਜਾਂ ਸਾੜੀ ਜਾਣ ਵਾਲੀ ਪਰਾਲੀ ਵੀ ਖੇਤੀਬਾੜੀ ਨੂੰ ਅੱਗੇ ਆਉਣ ਵਾਲੀਆਂ ਫਸਲਾਂ ਨੂੰ ਪ੍ਰਭਾਵਿਤ ਕਰਦੀ ਹੈ ਇਹਨਾਂ ਸਭ ਦੇ ਉਪਾਅ ਦੇ ਲਈ ਵੱਡੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਖਾਸ ਕਰਕੇ ਪਾਣੀ ਨੂੰ ਸਾਫ਼ ਰੱਖਣ ਲਈ ਅਤੇ ਹਵਾ ਨੂੰ ਸਾਫ਼ ਰੱਖਣ ਲਈ ਜੇਕਰ ਵੱਧ ਤੋਂ ਵੱਧ ਦਰਖ਼ਤ ਲਗਾਏ ਜਾਣ ਤਾਂ ਬੇਮੌਸਮੀ ਮੀਂਹ ਉੱਪਰ ਫਰਕ ਪੈ ਸਕਦਾ ਹੈ ਦਰਖ਼ਤ ਲਗਾਉਣ ਨਾਲ ਗਰਮੀ ਵੀ ਵੱਧਣੀ ਘੱਟ ਜਾਵੇਗੀ ਅਤੇ ਤਾਪਮਾਨ ਫਸਲਾਂ ਦੇ ਅਨੁਕੂਲ ਹੋਣਾ ਸ਼ੁਰੂ ਹੋ ਜਾਵੇਗਾ